ਹੈਲੋ ਹਾਂਜੀ ਸਾਈਕਲ ਸਟੋਰ ਤੋਂ ਗੱਲ ਕਰ ਰਿਹਾ ਜੀ ਹਾਂਜੀ ਸਾਡੇ ਕੋਲ ਮੈਡਮ ਸਾਰੀਆਂ ਕੰਪਨੀਆਂ ਦੇ ਸਾਈਕਲ ਹੈਗੇ ਆ ਹੀਰੋ ਐਟਲੈਸ ਹੀਰੋ ਚੈਂਪੀਅਨ ਨੀਲਮ ਅਤੇ ਬੱਚਿਆ ਵਾਸਤੇ ਸਪੈਸ਼ਲ ਵੀ ਆ ਅਤੇ ਟਿਊਬਲੈੱਸ ਵੀ ਆ ਟਾਇਰ ਟਾਇਰ ਟਿਊਬਲੈੱਸ ਸਾਈਕਲ ਵੀ ਆ ਅਤੇ ਗੇਅਰਸ ਵਿੱਚ ਵੀ ਆ ਅਤੇ ਤੁਸੀਂ ਕਿਹੜਾ ਲੈਣਾ ਪਸੰਦ ਕਰੋਗੇ ਇਹਨਾ ਦਾ ਪ੍ਰਾਈਸ ਸਾਰਿਆ ਦਾ ਵੱਖੋ ਵੱਖ ਆ ਅਤੇ ਤੁਸੀਂ ਦੱਸੋ ਵੀ ਕਿਵੇਂ ਦਾ ਸਾਈਕਲ ਲੈਣਾ ਆ ਰੇਂਜਰ ਟਾਈਪ ਆ ਜਾਂਦਾ ਆ ਅਤੇ ਕਿਵੇਂ ਤੁਸੀਂ ਤੁਹਾਨੂੰ ਕਿਵੇਂ ਦਾ ਸਾਈਕਲ ਚਾਹੀਦਾ ਆ ਤੁਸੀਂ ਇੱਕ ਵਾਰੀ ਆ ਕੇ ਦੇਖੋਂਗੇ ਤਾਂ ਪਤਾ ਲੱਗੂਗਾ ਅਤੇ ਤੁਸੀਂ ਅੱਠ ਸਾਲ ਦੇ ਬੱਚੇ ਵਾਸਤੇ ਸਾਈਕਲ ਲੈਣਾ ਅਤੇ ਪਰੇ ਪ੍ਰਾਈਜ਼ ਸਾਡੇ ਬੱਚਿਆਂ ਦੇ ਸਾਈਕਲਾਂ ਦੇ ਪੰਦਰਾਂ ਸੌ ਤੋਂ ਸਟਾਰਟ ਹੋ ਜਾਂਦੇ ਨੇ ਛੋਟਿਆਂ ਦੇ ਅਤੇ ਇਸ ਤੋਂ ਉੱਤੇ ਤੱਕ ਜਾਂਦੇ ਨੇ

ਵਧੀਆ ਕੁਆਲਟੀ ਦੇ ਨੇ ਸਾਈਕਲ ਤਾਂ ਕਾਫ਼ੀ ਟਾਇਮ ਸਾਈਕਲ ਚੱਲ ਜਾਂਦੇ ਨੇ ਹਾਂਜੀ ਅਤੇ ਬਾਕੀ ਜੇ ਤੁਸੀਂ ਚਾਹੁੰਦੇ ਜੇ ਤਾਂ ਤੁਹਾਡੇ ਨੰਬਰ 'ਤੇ ਅਸੀਂ ਵਟਸਐੱਪ 'ਤੇ ਫੋਟੋਆਂ ਭੇਜ ਸਕਦੇ ਹਾਂ ਆਪ ਆ ਕੇ ਦੇਖਣਾ ਚਾਹੁੰਦੇ ਤਾਂ ਤੁਸੀਂ ਦੇਖ ਸਕਦੇ ਹੋ ਹਾਂਜੀ ਠੀਕ ਹੈ ਜੀ ਓਕੇ ਓਕੇ ਜੀ